ਜੇਕਰ ਅਸੀਂ ਆਪਣੇ ਘਰ ਦੀ ਗੱਲ ਕਰੀਏ ਤਾਂ ਸਾਡੇ ਘਰ ਦੇ ਵਿੱਚ ਹੀ ਬਹੁਤ ਵੱਡਾ ਵਿਹੜਾ ਹੈਗਾ ਆ ਅਤੇ ਉਸਦੇ ਨਾਲ ਹੀ ਇੱਕ ਅੰਬਾਂ ਦਾ ਬਾਗ ਵੀ ਹੈ ਜੋ ਕਿ ਪੰਛੀਆਂ ਨੂੰ ਬਹੁਤ ਆਕਰਸ਼ਿਤ ਲੱਗਦਾ ਹੈ ਗਰਮੀਆਂ ਦੇ ਵਿੱਚ ਉਹਨਾਂ ਨੂੰ ਠੰਡੀ ਥਾਂ ਦੀ ਲੋੜ ਹੁੰਦੀ ਹੈਗੀ ਆ ਅਤੇ ਉਹ ਉਸ ਬਾਗ ਦੇ ਵਿੱਚ ਆ ਕੇ ਬੈਠ ਜਾਂਦੇ ਹਨ ਅਤੇ ਬਹੁਤ ਹੀ ਸ਼ੋਰ ਕਰਦੇ ਹਨ ਉਹਨਾਂ ਦੀ ਚ ਸ਼ੋਰ ਸੁਣ ਕੇ ਮੈਂ ਸਵੇਰ ਨੂੰ ਉੱਠਦੀ ਹੈਗੀ ਹਾਂ ਅਤੇ ਅਸੀਂ ਆਪਣੇ ਘਰ ਦੇ ਵਿਹੜੇ ਵਿੱਚ ਉਹਨਾਂ ਦੇ ਲਈ ਅਨਾਜ ਅਤੇ ਪਾਣੀ ਵੀ ਰੱਖਦੇ ਹਾਂ ਜਿਨ੍ਹਾਂ ਨੂੰ ਉਹ ਰੋਜ਼ ਖਾਣ ਅਤੇ ਪਾਣੀ ਪੀਣ ਦੇ ਲਈ ਆਉਂਦੇ ਹਨ ਇਸ ਤਰ੍ਹਾਂ ਹੀ ਸਵੇਰ ਨੂੰ ਅਸੀਂ ਰੋਟੀ ਖਾਣ ਤੋਂ ਪਹਿਲਾਂ ਪੰਛੀਆਂ ਨੂੰ ਰੋਟੀ ਪਾਉਂਦੇ ਹੈਗੇ ਹਾਂ ਕੋਠੇ ਉੱਤੇ ਅਤੇ ਉਹ ਕੋਠੇ ਉੱਤੇ ਰੋਜ਼ ਹੀ ਆਉਂਦੇ ਹਨ ਅਤੇ ਰੋਟੀ ਖਾ ਕੇ ਜਾਂਦੇ ਹਨ ਅਤੇ ਉਹ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈਗਾ ਆ ਅਸੀਂ ਜੇ ਦੇਖਿਆ ਜਾਵੇ ਤਾਂ ਸਾਨੂੰ ਆਪਣੇ ਸਾਰੇ ਸਾਰੇ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਪੰਛੀਆਂ ਦੇ ਲਈ ਪਾਣੀ ਅਤੇ ਅਨਾਜ ਰੱਖਣਾ ਚਾਹੀਦਾ ਹੈ ਜੇ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਇਹ ਪੰਛੀਆਂ ਨੂੰ ਜੇ ਪਾਣੀ ਅਤੇ ਅਨਾਜ ਨਹੀਂ ਮਿਲੇਗਾ ਤਾਂ ਉਹ ਮਰ ਜਾਣਗੇ ਅਤੇ ਇਸ ਤਰ੍ਹਾਂ ਇਹਨਾਂ ਦਾ ਲ ਜੋ ਵੀ ਅ ਪੰਛੀਆਂ ਦਾ ਸਾਰਾ ਕੁਛ ਖਤਮ ਹੋ ਜਾਵੇਗਾ ਉਹਨਾਂ ਨੂੰ ਜੇ ਪਾਣੀ ਜਾਂ ਫਿਰ ਅਨਾਜ ਨਾ ਮਿਲਿਆ ਤਾਂ ਕਿਉਂਕਿ ਉਹ ਭੁੱਖੇ ਰਹਿ ਜਾਣਗੇ ਅਤੇ ਫਿਰ ਉਹਨਾਂ ਦੀ ਜਾਨ ਚਲੀ ਜਾਵੇਗੀ ਇਸ ਤਰ੍ਹਾਂ ਪੰਛੀਆਂ ਦੀ ਜਿੰਨੀਆਂ ਵੀ ਜਾਤਾਂ ਹਨ ਉਹ ਸਾਰੀਆਂ ਖਤਮ ਹੋ ਜਾਣਗੀਆਂ ਜੇਕਰ ਅਸੀਂ ਇਹਨਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੇ ਘਰ ਦੇ ਬਾਹਰ ਇਹਨਾਂ ਲਈ ਪਾਣੀ ਅਤੇ ਖਾਣਾ ਜ਼ਰੂਰ ਰੱਖਣਾ ਚਾਹੀਦਾ ਹੈ